ਪਰਿਵਾਰ ਵਿੱਚ ਆਦਮੀ ਅਤੇ ਔਰਤ ਦਾ ਦੋਨਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ ਪਰਿਵਾਰ ਵਿੱਚ ਆਦਮੀ ਬਾਹਰ ਦੇ ਕੰਮ ਅਤੇ ਕਾਰੋਬਾਰ ਸੰਭਾਲਦਾ ਹੈ ਅਤੇ ਔਰਤ ਘਰ ਦੇ ਸਾਰੇ ਕੰਮ ਸੰਭਾਲਦੀ ਹੈ ਅਤੇ ਇਹ ਦੋਨੋਂ ਰਲ ਮਿਲ ਕੇ ਪਰਿਵਾਰ ਨੂੰ ਚਲਾਉਂਦੇ ਹਨ ਅਤੇ ਇਸ ਤਰ੍ਹਾਂ ਇਹ ਦੋਵੇਂ ਜਾਣੇ ਆਪਣੇ ਪਰਿਵਾਰ ਨੂੰ ਹੱਸਦਾ ਖੇਡਦਾ ਰੱਖਦੇ ਹਨ ਅਤੇ ਚੰਗੀ ਦਿਸ਼ਾ ਵਿੱਚ ਲੈ ਕੇ ਜਾਂਦੇ ਹਨ